ਹੈਲੋ ਮੈਂ ਸਿਮਰਨ ਗੱਲ ਕਰ ਰਹੀ ਹਾਂ ਮੈਂ ਤੁਹਾਡਾ ਰੂਟੀਨ ਕਸਟਮਰ ਹੀ ਹੈਗੀ ਹੈ ਮੈਂ ਤੁਹਾਨੂੰ ਪਿਛਲੀ ਪਾਰਟੀ ਦੇ ਵਿੱਚ ਔਡਰ ਕੀਤਾ ਸੀ ਪੀਜ਼ਾ ਪਾਸਤਾ ਅਤੇ ਮਨਚੂਰੀਅਨ ਬੋਲ ਵਿਦ ਗਰੇਵੀ ਔਰ ਚੀਜ਼ ਬੋਲ ਤੁਹਾਨੂੰ ਮੈਂ ਦਿੱਤੇ ਸੀ ਔਡਰ ਕੀਤੇ ਸੀ ਅਤੇ ਮੈਂ ਤੁਹਾਨੂੰ ਆਪਣੀਆਂ ਕੰਡੀਸ਼ਨਿਸ ਨਾਲ ਦੱਸੀਆਂ ਸੀ ਕਿ ਮੈਨੂੰ ਮਿਰਚ ਵਾਲਾ ਖਾਣਾ ਨਹੀਂ ਚਾਹੀਦਾ ਪੀਜ਼ਾ ਬੇਸ ਸੋਫਟ ਚਾਹੀਦਾ ਪਾਸਤਾ ਵੀ ਵਧੀਆ ਤਰੀਕੇ ਦੇ ਨਾਲ ਬਣਿਆ ਹੋਣਾ ਚਾਹੀਦਾ ਹੈ ਔਰ ਮਨਚੂਰੀਅਨ ਵਿਦ ਗਰੇਵੀ ਚਾਹੀਦਾ ਇਹ ਮੈਂ ਹਦਾਇਤਾਂ ਤੁਹਾਨੂੰ ਦਿੱਤੀਆਂ ਸੀ ਲੇਕਿਨ ਤੁਸੀਂ ਮੈਨੂੰ ਉਸ ਅਕੋਰਡਿੰਗਲੀ ਸਰਵ ਨਹੀਂ ਕੀਤਾ ਮੇਰੀ ਪਾਰਟੀ ਕਾਫੀ ਖ਼ਰਾਬ ਗਈ ਅਤੇ ਮੈਨੂੰ ਤੁਸੀਂ ਆਪਣੀਆਂ ਕੁਛ ਉਸ ਹਿਸਾਬ ਨਾਲ ਆਪਣੀਆਂ ਕੁਛ ਐਡਰੈੱਸ ਦੇਵੋ ਕੋਈ ਵੈਬਸਾਈਟ ਦੱਸੋ ਕੋਈ ਐਪ ਦੱਸੋ ਜਿਹਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਆਪਣੀਆਂ ਹਦਾਇਤਾਂ ਨੋਟ ਕਰਕੇ ਦੇ ਸਕਾਂ ਜਿਹਦੇ ਉੱਤੇ ਤੁਸੀਂ ਅਮਲ ਕਰੋ ਅਤੇ ਆਪਣੇ ਰੈਸਟੋਰੈਂਟ ਦੀ ਜਿਸ ਤਰ੍ਹਾਂ ਕੋਈ ਵੀ ਵਿਸ਼ੇਸ਼ਤਾ ਵਾ ਜਿੱਥੇ ਵੀ ਮੈਂ ਤੁਹਾਨੂੰ ਆਪਣੀਆਂ ਹਦਾਇਤਾਂ ਲਿਖ ਕੇ ਤੁਹਾਨੂੰ ਦੇ ਸਕਾਂ ਅਤੇ ਤੁਸੀਂ ਉਸ ਹਿਸਾਬ ਦੇ ਨਾਲ ਮੈਨੂੰ ਆਪਣਾ ਖਾਣਾ ਡਿਲੀਵਰ ਕਰੋ